ਸਾਡੇ ਰਾਜ ਪੰਜਾਬ ਦੇ ਵਿੱਚ ਬੱਸ ਅਤੇ ਟ੍ਰੇਨ ਆਵਾਜਾਈ ਦੇ ਸਾਧਨ ਹਨ ਇਹ ਸਾਫ ਸੁਥਰੇ ਹਨ ਅਤੇ ਲੋਕ ਇਹਨਾਂ ਵਿੱਚ ਸਫਰ ਕਰਨਾ ਪਸੰਦ ਕਰਦੇ ਹਨ ਅਤੇ ਇਹ ਸੁਰੱਖਿਅਤ ਵੀ ਹਨ ਕਿਫਾਇਤੀ ਵੀ ਹਨ ਅਤੇ ਬੱਸ ਸੁਧਾਰ ਤਾਂ ਇੰਨਾਂ ਕੁ ਹੀ ਹੋਣਾ ਚਾਹੀਦਾ ਹੈ ਕਿ ਇਹਨਾਂ ਦੇ ਵਿੱਚ ਸਾਫ ਸਫਾਈ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਇਹਨਾਂ ਦੀ ਟੈਮ ਟੂ ਟੈਮ ਸਰਵਿਸ ਵਗੈਰਾ ਜੋ ਵੀ ਹੈ ਉਹ ਸਹੀ ਤਰੀਕੇ ਨਾਲ ਹੋਣੀ ਚਾਹੀਦੀ ਹੈ ਅਤੇ ਕੈਮਰੇ ਲੱਗੇ ਹੋਣੇ ਚਾਹੀਦੇ ਹਨ